ਰੂਪਨਗਰ ਜ਼ਿਲ੍ਹੇ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਤਿਉਹਾਰ ਹੈ ਉਹ ਗੜਬੜੇ ਹੈ ਬੱਚੇ ਰੌਸ਼ਨੀ ਗੜਬੜੇ ਵਿੱਚ ਲੈ ਕੇ ਜਾਂਦੇ ਹਨ ਘਰ ਘਰ ਜਾਂਦੇ ਹਨ ਅਤੇ ਘਰਾਂ ਵਾਲੇ ਉਨ੍ਹਾਂ ਨੂੰ ਕੁਝ ਪੈਸੇ ਜਾਂ ਕੁਝ ਹੋਰ ਵਸਤਾਂ ਦੇ ਕੇ ਤੋਰਦੇ ਹਨ ਇਹ ਸਮਾਜ ਦੀ ਆਪਸੀ ਮਿਲਵਰਤਨ ਇੱਕ ਦੂਜੇ ਨੂੰ ਰੁਸ਼ਨਾਈ ਬਖਸ਼ਣ ਦਾ ਤਿਉਹਾਰ ਹੈ ਇੱਕ ਦੂਜੇ ਦੀ ਮਿਲਵਰਤਨ ਦਾ ਤਿਉਹਾਰ ਹੈ